ਜਿਹੜੇ ਮੱਛੀ ਪਾਲਣ ਵਾਸਤੇ ਉਹਦੇ ਵਾਸਤੇ ਜਾਂ ਮੱਛੀਆਂ ਫੜਨ ਵਾਸਤੇ ਬਹੁਤ ਸਾਰੇ ਮਤਲਬ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਹੈ ਬਹੁਤ ਸਾਰੇ ਵਾਤਾਵਰਣ ਸੰਭਾਲ ਦੇ ਤਰੀਕੇ ਹੈਗੇ ਪਹਿਲਾਂ ਤਾਂ ਇਹੀ ਗੱਲ ਹੁੰਦੀ ਹੈਗੀ ਹੈ ਬਈ ਜਿੱਦਾਂ ਜਿਹੜੇ ਮੱਛੀਆਂ ਜਿਹੜੀਆਂ ਸਾਫ ਪਾਣੀ 'ਚ ਵਧੀਆ ਜਿਉਂਦੀਆਂ ਰਹਿ ਸਕਦੀਆਂ ਹੈਗੀਆਂ ਹੈ ਮਤਲਬ ਪਾਣੀ ਪਹਿਲਾਂ ਸਾਫ ਹੋਣਾ ਚਾਹੀਦਾ ਹੈਗਾ ਜ਼ਰੂਰੀ ਹੈ ਉਹਦੀ ਬੇਸਿਕ ਨੀਡ ਹੈਗੀ ਹੈ